ਮੇਰਾ ਨਾਮ ਸ਼ਿਵੀ ਹੈ ਅਤੇ ਮੈਂ ਇੱਕ ਇੰਸੀਡੈਂਸ ਸਾਂਝਾ ਕਰਨਾ ਚਾਹੁੰਦੀ ਹਾਂ ਜਿਹਦੇ 'ਚ ਮੈਂ ਇੱਕ ਕੈ ਅੋਟੋ ਡ੍ਰੈ ਵਿੱਚ ਰਾਤ ਨੂੰ ਆਈ ਸੀ ਅਤੇ ਸਮਾਂ ਕੁਛ ਸਵਾ ਕੁ ਦਸ ਹੋ ਚਲਿਆ ਸੀਗਾ ਅਤੇ ਮੈਂ ਇਕੱਲੀ ਸੀਗੀ ਅਤੇ ਮੈਨੂੰ ਐਮਰਜੈਂਸੀ ਕਰਕੇ ਅੋਫਿਸ ਵਿੱਚ ਰੁਕਣਾ ਪਿਆ ਜਿਸ ਕਰਕੇ ਮੈਂ ਇੰਨੀ ਲੇਟ ਹੋ ਗਈ ਸੀ ਅਤੇ ਉਹ ਜਿਹੜਾ ਮੇਰਾ ਅੋਟੋ ਵਾਲਾ ਸੀਗਾ ਉਹ ਬਹੁਤ ਹੀ ਜ਼ਿਆਦਾ ਵਧੀਆ ਮਤਲਬ ਇੱਕ ਹੰਬਲ ਇਨਸਾਨ ਸੀਗਾ ਅਤੇ ਉਹ ਮੈਨੂੰ ਮਤਲਬ ਜਿਹੜਾ ਜਿੱਥੇ ਉਹਨੇ ਮੈਨੂੰ ਉਤਾਰਨਾ ਸੀਗਾ ਉਹ ਮੈਨੂੰ ਉੱਥੇ ਨਹੀਂ ਉਤਾਰ ਕੇ ਗਿਆ ਈਵਨ ਉਹ ਮੈਨੂੰ ਘਰ ਤੱਕ ਜਿਹੜਾ ਉਹ ਕਹਿੰਦਾ ਮੈਂ ਤੁਹਾਨੂੰ ਛੱਡ ਦਿੰਦਾ ਅਤੇ ਉਹਨੇ ਮੇਰੇ ਕੋਲ ਪੈਸੇ ਵੀ ਜਿਹੜੇ ਵੱਧ ਨਹੀਂ ਚਾਰਜ ਕੀਤੇ ਜਿਹੜੇ ਨੋਰਮਲ ਮੇਨ ਰੋਡ ਦੇ ਸੀਗੇ ਉਨੇ ਹੀ ਚਾਰਜ ਕੀਤੇ ਕਾਫੀ ਮਤਲਬ ਵਧੀਆ ਲੱਗਦਾ ਪਿਆ ਸੀ ਮੈਨੂੰ ਉਹਨੇ ਮਤਲਬ ਗੱਲਬਾਤ ਵੀ ਮੇਰੇ ਨਾਲ ਕੀਤੀ ਅਤੇ ਮੈਨੂੰ ਮਤਲਬ ਉਹਨੇ ਆਪ ਪੁੱਛਿਆ ਕਿ ਤੁਸੀਂ ਅੱਗੇ ਕਿੱਥੇ ਜਾਣਾ ਅਤੇ ਮੈਂ ਤੁਹਾਨੂੰ ਉੱਥੇ ਛੱਡ ਆਉਂਦਾ ਅੱਜ ਕੱਲ੍ਹ ਦੇ ਜ਼ਮਾਨੇ 'ਚ ਜਿੱਥੇ ਇੰਨੇ ਜਿਆਦਾ ਹਾਦਸੇ ਹੋ ਰਹੇ ਨੇ ਅਤੇ ਤੁਸੀਂ ਕਿਸੇ ਬੇਗਾਨਿਆਂ ਦੇ ਉੱਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰ ਸਕਦੇ ਪਰ ਮੈਨੂੰ ਐਦਾਂ ਲੱਗਾ ਕਿ ਜਿਹੜਾ ਮੇਰਾ ਅੋਟੋ ਡਰਾਈਵਰ ਸੀਗਾ ਉਹ ਕਾਫੀ ਵਧੀਆ ਸੀਗਾ ਅੱਜ ਕੱਲ੍ਹ ਦੇ ਜ਼ਮਾਨੇ 'ਚ ਸੀਰੀਅਸਲੀ ਇੱਦਾਂ ਦੇ ਬੰਦੇ ਬਿਲਕੁਲ ਨਹੀਂ ਮਿਲਦੇ ਪਰ ਮੈਨੂੰ ਬਹੁਤ ਵਧੀਆ ਲੱਗਾ ਉਹਦੇ ਨਾਲ ਜਾਣਾ ਅਤੇ ਉਹਦਾ ਮੈਨੂੰ ਘਰ ਤੱਕ ਛੱਡਣਾ ਈਵਨ ਮੈਂ ਫਿਰ ਉਹਨੂੰ ਆਪਣੇ ਹਸਬੈਂਡ ਨਾਲ ਵੀ ਮਿਲਵਾਇਆ ਕਿ ਉਹ ਬਹੁਤ ਖੁਸ਼ ਹੋਏ ਦੇਖ ਕੇ ਕਿ ਵੀ ਹਾਂ ਚਲੋ ਵਧੀਆ ਕੋਈ ਤੁਹਾਡੇ ਨਾਲ ਮਤਲਬ ਇੰਨਾ ਕਰ ਰਿਹਾ ਉਹ ਤੁਹਾਨੂੰ ਘਰ ਤੱਕ ਛੱਡਣ ਆਇਆ ਅਤੇ ਉਹਨੂੰ ਐਟਲੀਸਟ ਮਤਲਬ ਥੋੜ੍ਹਾ ਤਾਂ ਉਹਾਨੂੰ ਗ੍ਰੀਟ ਕਰਨਾ ਚਾਹੀਦਾ ਹੈ